ਹਰ ਬ ਨਵਾਂ ਬੱਚਾ ਆਪਣੇ ਕਰਮ ਆਪਣੇ ਆਪ ਲਿਖਵਾ ਕੇ ਆਉਂਦਾ ਹੈ ਜੇਕਰ ਅਸੀਂ ਗੱਲ ਕਰੀਏ ਨਵਜੰਮੇ ਬੱਚੇ ਮੋ ਮੁੰਡੇ ਹੋਏ ਜ਼ਾਂ ਕੁੜੀ ਲਈ ਦੋਨਾਂ ਦੇ ਆਪਣੇ ਆਪਣੇ ਇੱਕ ਰੀਤੀ ਰਿਵਾਜ਼ ਅਤੇ ਵੱਖ ਵੱਖ ਰਸਮਾਂ ਹੁੰਦੀਆਂ ਹਨ ਨਵਜੰਮੇ ਮਨ ਮੁੰਡੇ ਅਤੇ ਲਈ ਘਰ ਦੇ ਵਿੱਚ ਬਹੁਤ ਹੀ ਉਤਸ਼ਾਹ ਨਾਲ ਲੋਹੜੀ ਮਨਾਈ ਜਾਂਦੀ ਹੈ ਘਰ ਦੇ ਵਿੱਚ ਬਹੁਤ ਸਾਰੀਆਂ ਰਸਮਾਂ ਇੱਦਾਂ ਅਜਿਹੀਆਂ ਹੁੰਦੀਆਂ ਹਨ ਜੋ ਕਿ ਵਾਜੇ ਗਾਜੇ ਨਾਲ ਮਨਾਈ ਜਾਂਦੀ ਹੈ ਜਿਸ ਤਰ੍ਹਾਂ ਕਿ ਬ ਮਾਂ ਮਾਂ ਦੇ ਪੇਕੇ ਬੱਚੇ ਦੇ ਘਿਓ ਲੈ ਕੇ ਆਉਂਦੇ ਹਨ ਇਹ ਕੁੜੀ ਔਰ ਮੁੰਡੇ ਦੋਨਾਂ ਦੇ ਵਿੱਚ ਹੀ ਦਿੱਤਾ ਜਾਂਦਾ ਆ ਪਹਿਲੇ ਸਾਲ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਰੀਤਾਂ ਰਿਵਾਜਾਂ ਹੁੰਦੀਆਂ ਮੁੰਨਣ ਹੁੰਦੇ ਹਨ ਔਰ ਲੋਹੜੀ ਮਨਾਈ ਜਾਂਦੀ ਹੈ ਇਸ ਤੋਂ ਇਲਾਵਾ ਹੋਰ ਛੋਟੇ ਛੋਟੇ ਕਈ ਇੱਦਾਂ ਦੇ ਜੋ ਰਸਮਾਂ ਹੁੰਦੀਆਂ ਹਨ ਜੋ ਉਹਦੇ ਘਰ ਵਾਲਿਆਂ ਵੱਲੋਂ ਕੀਤੀ ਜਾਂਦੀ ਹੈ